ਮੈਂ ਐਮਾਜ਼ਨ ਆਨਲਾਈਨ ਐਪ ਤੋਂ ਇੱਕ ਪ੍ਰੋਡੈਕਟ ਗੀਜਰ ਔਡਰ ਕੀਤਾ ਸੀ ਇਹ ਮੈਂ ਦਸ ਦਿਨ ਪਹਿਲਾਂ ਔਡਰ ਕੀਤਾ ਸੀ ਅਤੇ ਜਦੋਂ ਮੈਂ ਔਡਰ ਕੀਤਾ ਤਾਂ ਇਹਦੇ ਵਿੱਚ ਮੈਨਸ਼ਨ ਸੀ ਕਿ ਤੁਹਾਡਾ ਪ੍ਰੋਡਕਟ ਤੁਹਾਡੇ ਤੱਕ ਸੱਤ ਦਿਨਾਂ ਦੇ ਅੰਦਰ ਅੰਦਰ ਡਲ ਡਿਲੀਵਰ ਕਰ ਦਿੱਤਾ ਜਾਵੇਗਾ ਠੰਡ ਦੇ ਕਾਰਨ ਮੈਨੂੰ ਗੀਜਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ ਅਤੇ ਮੈਂ ਚਾਹੁੰਦਾ ਸੀ ਕਿ ਜਲਦੀ ਹੀ ਪਹੁੰਚ ਜਾਵੇ ਅਤੇ ਛੇ ਦਿਨਾਂ ਦੇ ਅੰਦਰ ਅੰਦਰ ਗੀਜਰ ਮੇਰੇ ਘਰ ਪਹੁੰਚ ਗਿਆ ਅਤੇ ਇਹਦੀ ਪੈਕਿੰਗ ਬਹੁਤ ਹੀ ਵਧੀਆ ਢੰਗ ਨਾਲ ਕਰੀ ਹੋਈ ਸੀ ਅਤੇ ਇਹ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਸੀ ਹੁਣ ਮੈਨੂੰ ਇਹਨੂੰ ਯੂਜ਼ ਕਰਦੇ ਹੋਏ ਚਾਰ ਦਿਨ ਹੋ ਗਏ ਹਨ ਇਹ ਬਹੁਤ ਹੀ ਵਧੀਆ ਕੰਡੀਸ਼ਨ ਦੇ ਨਾਲ ਚੱਲ ਰਿਹਾ ਹੈ ਅਤੇ ਇਹ ਬਹੁਤ ਹੀ ਵਧੀਆ ਢੰਗ ਨਾਲ ਅਤੇ ਬਹੁਤ ਹੀ ਜਲਦੀ ਪਾਣੀ ਨੂੰ ਗਰਮ ਕਰ ਦਿੰਦਾ ਹੈ ਅਤੇ ਇਹਦੇ ਨਾਲ ਬਿਜਲੀ ਦੀ ਖਪਤ ਵੀ ਬਹੁਤ ਘੱਟ ਹੁੰਦੀ ਹੈ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਕ ਐਡੇ ਵੱਡੇ ਲੈਵਲ 'ਤੇ ਹੋਣ 'ਤੇ ਵੀ ਆਪਣੇ ਕਸਟਮਰਾਂ ਦਾ ਇੰਨਾ ਧਿਆਨ ਰੱਖਦੇ ਹਨ